ਪੰਜਾਬੀ ਲੋਕ ਆਪਣੀ ਭਾਸ਼ਾ ਦੀ ਵਰਤੋਂ ਦੂਜਿਆਂ ਨਾਲ ਗੱਲਬਾਤ ਕਰਨ ਲਈ ਇਸ ਤਰ੍ਹਾਂ ਕਰਦੇ ਹਨ ਪਹਿਲਾਂ ਤਾਂ ਉਹਨਾਂ ਨੂੰ ਜ਼ਿਆਦਾਤਰ ਕੀ ਹੁੰਦਾ ਹੈ ਵੀ ਪੰਜਾਬੀ ਬੋਲਣ ਵਿੱਚ ਉਹਨਾਂ ਨੂੰ ਪੰਜਾਬੀ ਅਤੇ ਹਿੰਦੀ ਵਿੱਚ ਮਿਕਸ ਅਪ ਕਰਕੇ ਦੋਹਾਂ ਦੇ ਇੱਕ ਕੋਂਬੀਨੇਸ਼ਨ ਬਣਾ ਕੇ ਉਸ ਚੀਜ਼ ਨੂੰ ਸਮਝਾਇਆ ਜਾਂਦਾ ਹੈ ਕਿ ਤੁਸੀਂ ਜੇਕਰ ਕੋਈ ਬੰਦਾ ਹਿੰਦੀ ਬੋਲਦਾ ਹੈ ਤਾਂ ਉਸਨੂੰ ਪੰਜਾਬੀ ਸਮਝਾਉਣੀ ਬਹੁਤ ਸੌਖੀ ਹੈ ਕਿਉਂਕਿ ਪੰਜਾਬੀ ਅਤੇ ਹਿੰਦੀ ਦਾ ਦੋਵਾਂ ਦਾ ਮੇਲ ਜਾ ਬਣਦਾ ਹੈ ਅਤੇ ਹਿੰਦੀ ਬੋਲਣ ਵਾਲਾ ਬੰਦਾ ਪੰਜਾਬੀ ਛੇਤੀ ਸਮਝ ਲੈਂਦਾ ਹੈ ਉਸ ਨੂੰ ਪੰਜਾਬੀ ਬੰਦਾ ਅੱਧੀ ਪੰਜਾਬੀ ਅੱਧੀ ਹਿੰਦੀ ਬੋਲ ਕੇ ਸਮਝਾ ਸਕਦਾ ਹੈ ਅਤੇ ਜੋ ਇੰਗਲਿਸ਼ ਬੋਲਦੇ ਲੋਕ ਹਨ ਉਨਾਂ ਨੂੰ ਪੰਜਾਬੀ ਬੰਦਾ ਇੰਗਲਿਸ਼ ਦੇ ਵਿੱਚ ਬਹੁਤ ਔਖਾ ਹੈ ਉਸ ਨੂੰ ਸਮਝਾਉਣਾ ਪੰਜਾਬੀ ਬੰਦਾ ਜੋ ਪੰਜਾਬੀ ਬੋਲਦਾ ਹੈ ਜੋ ਪੜ੍ਹਿਆ ਲਿਖਿਆ ਹੈ ਜੋ ਇੰਗਲਿਸ਼ ਪੜ੍ਹ ਲੈਂਦਾ ਹੈ ਮਾੜੀ ਮੋਟੀ ਉਹ ਤਾਂ ਕਿਸੇ ਤਰੀਕੇ ਨਾਲ ਪੰਜਾਬੀ ਨੂੰ ਐਕਸਪਲੇਨ ਕਰਕੇ ਅੰਗਰੇਜ਼ੀ ਦੇ ਵਿੱਚ ਕਿਸੇ ਵੀ ਤਰੀਕੇ ਦੇ ਨਾਲ ਬੋਲਿਆ ਜਾ ਸਕਦਾ ਹੈ ਸੁਣਾਇਆ ਜਾ ਸਕਦਾ ਹੈ ਪਰ ਜੇਕਰ ਬੰਦਾ ਘੱਟ ਪੜ੍ਹਿਆ ਲਿਖਿਆ ਹੈ ਉਹ ਸਿਰਫ ਪੰਜਾਬੀ ਹੀ ਜਾਣਦਾ ਹੈ ਪੰਜਾਬੀ ਤੋਂ ਇਲਾਵਾ ਹੋਰ ਕੋਈ ਭਾਸ਼ਾ ਨਹੀਂ ਬੋਲ ਸਕਦਾ ਅਤੇ ਉਸ ਨੂੰ ਇਹ ਸਮਝਾਉਣ ਵਿੱਚ ਕਾਫੀ ਦਿੱਕਤ ਆਵੇਗੀ ਕਿਉਂਕਿ ਪੰਜਾਬੀ ਬੰਦਾ ਸਿਰਫ ਪੰਜਾਬੀ ਹੀ ਬੋਲ ਸਕਦਾ ਹੈ ਵੱਧ ਤੋਂ ਵੱਧ ਉਹ ਹਿੰਦੀ ਬੋਲ ਕੇ ਕਿਸੇ ਨੂੰ ਦੂਜੇ ਬੰਦੇ ਨੂੰ ਸਮਝਾ ਲਵੇਗਾ ਪਰ ਜੇਕਰ ਕਿਸੇ ਹੋਰ ਭਾਸ਼ਾ ਜਿੱਦਾਂ ਤਾਮਿਲਨਾਡੂ ਦੀਆਂ ਬ ਭਾਸ਼ਾਵਾਂ ਨੇ ਜਾਂ ਕੋਈ ਹੋਰ ਕੇਰਲ ਵਗੈਰਾ ਦੀਆਂ ਜਾਂ ਫਿਰ ਮਹਾਰਾਸ਼ਟਰ ਦੀਆਂ ਇੱਦਾਂ ਦੀਆਂ ਉਤਰਾਂਚਲੀ ਭਾਸ਼ਾ ਹਨ ਉਹਨਾਂ ਨੂੰ ਸਮਝਾਉਣ ਦੇ ਵਿੱਚ ਪੰਜਾਬੀ ਬੰਦੇ ਨੂੰ ਬਹੁਤ ਜ਼ਿਆਦਾ ਸ ਦਿੱਕਤਾਂ ਦਾ ਸਾਹਮਣਾ ਕਰਨਾ ਪਵੇਗਾ ਅਤੇ ਪੰਜਾਬੀ ਬੋਲਦੇ ਇਲਾਕਿਆਂ ਦੇ ਨਾਲ ਲੱਗਦੇ ਜਿੰਨੇ ਵੀ ਸੂਬੇ ਹਨ ਜਿੱਦਾਂ ਹਰਿਆਣਾ ਰਾਜਸਥਾਨ ਜਾਂ ਹੋਰ ਕੋਈ ਕਈ ਸੂਬੇ ਹੋਰ ਨਾਲ ਪੰਜਾਬ ਦੇ ਲੱਗਦੇ ਹਨ ਉਹਨਾਂ ਸੂਬਿਆਂ ਦੇ ਵਿੱਚ ਜ਼ਿਆਦਾਤਰ ਲੋਕ ਥੋੜ੍ਹੀ ਥੋੜ੍ਹੀ ਹਿੰਦੀ ਅਤੇ ਥੋੜ੍ਹੀ ਥੋੜ੍ਹੀ ਪੰਜਾਬੀ ਬੋਲਦੇ ਹਨ ਪਰ ਪੰਜਾਬੀ ਬੰਦਾ ਸਿਰਫ ਪੰਜਾਬੀ ਦੇ ਵਿੱਚ ਜਾਂ ਹਿੰਦੀ ਦੇ ਵਿੱਚ ਹੀ ਇੱਕ ਦੂਜੇ ਨੂੰ ਕੋਈ ਗੱਲ ਸਮਝਾ ਸਕਦਾ ਹੈ ਪਰ ਜੇਕਰ ਆਪਾਂ ਕਹੀਏ ਵੀ ਪੰਜਾਬੀ ਬੰਦਾ ਕਿਸੇ ਨੂੰ ਹੋਰ ਕਿਸੇ ਭਾਸ਼ਾ ਦੇ ਵਿੱਚ ਉਹ ਐਕਸਪਲੇਨ ਨਹੀਂ ਕਰ ਸਕਦਾ ਸਿਰਫ ਪੰਜਾਬੀ ਬੰਦਾ ਪੰਜਾਬੀ ਬੋਲਦੇ ਬੰਦੇ ਨੂੰ ਜਾਂ ਹਿੰਦੀ ਬੋਲਦੇ ਬੰਦੇ ਨੂੰ ਹੀ ਸਮਝਾ ਸਕਦਾ ਹੈ